ਦੁਧਾਰੂ ਪਸ਼ੂਆਂ ਦੀ ਮੂੰਹ ਖੁਰ ਦੀ ਬਿਮਾਰੀ ਜਿਵੇਂ ਕਿ ਮੂੰਹ ਵਿੱਚ ਛਾਲੇ ਖੁਰ ਭਾਵ ਪੈਰ ਗਲ ਜਾਂਦੇ ਹਨ ਉਹਨਾਂ ਨੂੰ ਸਹੀ ਨੈਚੁਰਲ ਤਰੀਕੇ ਨਾਲ ਸਹੀ ਕਰਨ ਵਾਸਤੇ ਮੂੰਹ ਦੇ ਵਿੱਚ ਲੂਣ ਮਲਿਆ ਜਾਂਦਾ ਹੈ ਤਾਂ ਕਿ ਛਾਲੇ ਸਹੀ ਹੋ ਹੋ ਸਕਣ ਅਤੇ ਹਰ ਸਾਲ ਵਿੱਚ ਇੱਕ ਵਾਰ ਇਹ ਬਿਮਾਰੀ ਆਉਂਦੀ ਹੈ ਦੇਸੀ ਤਰੀਕੇ ਹਨ ਜਿਵੇਂ ਲਾਲ ਲੂਣ ਕਾਲਾ ਲੂਣ ਜਵੈਣ ਦੇਸੀ ਜਵੈਣਾ ਪਸ਼ੂਆਂ ਦੇ ਅੱਗੇ ਰੱਖੀਆਂ ਜਾਂਦੀਆਂ ਹਨ ਉਹਨਾਂ ਦਾ ਚੂਰਨ ਬਣਾ ਕੇ ਵੀ ਕੌੜ ਤੁੰਬਿਆਂ ਰਾਹੀਂ ਦਿੱਤਾ ਜਾਂਦਾ ਹੈ ਅਤੇ ਉਹਨਾਂ ਨੂੰ ਜੇ ਇਹਨਾਂ ਤੋਂ ਵੀ ਨਾ ਠੀਕ ਹੋ ਸਕੇ ਤਾਂ ਇਹਨਾਂ ਦਾ ਡਾਕਟਰੀ ਇਲਾਜ ਵੀ ਟੀਕੇ ਵਗੈਰਾ ਲਾਏ ਜਾਂਦੇ ਹਨ ਪਸ਼ੂ ਕਈ ਵਾਰ ਇਹਨਾਂ ਦੀ ਇਸ ਬਿਮਾਰੀ ਨਾਲ ਇਹਨਾਂ ਦੀ ਮੌਤ ਵੀ ਹੋ ਜਾਂਦੀ ਹੈ